ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਇਲੈਕਟ੍ਰੀਸ਼ਨ ਦੀ ਕੰਪਨੀ ਤੋਂ ਗੱਲ ਕਰ ਰਹੇ ਹਾਂ ਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਭਾਅ ਜੀ ਤੁਸੀਂ ਸਾਰੇ ਆਪਣੀ ਪੂਰੇ ਘਰ ਦੀ ਕਰਵਾਉਣੀ ਹੈ ਜੀ ਇਲੈਕਟ੍ਰੀਸ਼ਨ ਦਾ ਕੰਮ ਅੱਛਾ ਠੀਕ ਹੈ ਜੀ ਵਾਇਰਿੰਗ ਵਗੈਰਾ ਵੀ ਅਤੇ ਪਾਈਪਿੰਗ ਵਗੈਰਾ ਕਰਤੀ ਭਾਅ ਜੀ ਸਾਰੀ ਕੰਪਲੀਟ ਆ ਜੀ ਪਾਈਪਿੰਗ ਵਗੈਰਾ ਦੇ ਵਿੱਚ ਪਾ ਤੀਆਂ ਜੀ ਹਾਂਜੀ ਹਾਂਜੀ ਵਾਇਰਿੰਗ ਤਾਂ ਹੋ ਜਾਵੇਗੀ ਕਈ ਵਾਰੀ ਹੁੰਦਾ ਨਾ ਜੀ ਇਕੱਲਾ ਇਲੈਕ ਆਪਣੇ ਵਾਇਰਿੰਗ ਦਾ ਕੰਮ ਹੁੰਦਾ ਨਾਲ ਆਪਣੇ ਬਲਬ ਵਗੈਰਾ ਦਾ ਵੀ ਕੰਮ ਹੈ ਨਾ ਵੀ ਵਾਇਰਿੰਗ ਦੇ ਨਾਲ ਬੱਲਬ ਵਗੈਰਾ ਵੀ ਫਿਟਿੰਗ ਹੁੰਦੀ ਹੈ ਸਾਰੀ ਆਪਣੇ ਤਾਂ ਕਰਕੇ ਜੀ ਪੁੱਛਦੇ ਹਾਂ ਅਸੀਂ ਵਾਇਰਿੰਗ ਵਗੈਰਾ ਦਾ ਵੀ ਕੰਮ ਕਰਨਾ ਜੀ ਹਾਂਜੀ ਹਾਂਜੀ ਭਾਅ ਜੀ ਦੇਖੋ ਲਾਈਟਿੰਗ ਦੇ ਵਿੱਚ ਹੁਣ ਤਾਂ ਕਾਫੀ ਕੰਪਨੀ ਆ ਰਹੀਆਂ ਜੀ ਅਤੇ ਤੁਸੀਂ ਇਹ ਦੇਖੋ ਜੀ ਆਪਣੇ ਐਲਈਡੀ ਲਾਈਟ ਲਾਣੀ ਹੈ ਜੀ ਦੂਜੀਆਂ ਅੱਜ ਕੱਲ੍ਹ ਦੂਜੇ ਬੱਲਬ ਵੀ ਚੱਲ ਰਹੇ ਹੈ ਜੀ ਕਲਰਫੁਲ ਜਿਹਨੂੰ ਆਪਾਂ ਕਹਿੰਦੇ ਰੰਗ ਬਿਰੰਗੇ ਜੇ ਉਹਦੇ 'ਚ ਵੀ ਹਾਂਜੀ ਹਾਂਜੀ ਉਹ ਇੱਕ ਤਾਂ ਜੀ ਕਾਟਿੰਗ ਇੱਕੋ ਰੰਗ ਦਾ ਜੰਗਲਾ ਜੀ ਇੱਕ ਅਲੱਗ ਅਲੱਗ ਤਰ੍ਹਾਂ ਦੇ ਰੰਗ ਹੁੰਦੇ ਆ ਜੀ ਉਹਨਾਂ ਦਾ ਬਲਬ ਦੇ ਉਸ ਹਿਸਾਬ ਨਾਲ ਵੀ ਹੈਗੇ ਆ ਜੀ ਆਪਣੇ ਕੋਲ ਬਲਬ ਦੀ ਕੁਆਲਿਟੀਆਂ ਅਤੇ ਉਹਦੇ ਵਿੱਚ ਹਾਂਜੀ ਹਾਂਜੀ ਸਾਰੇ ਹੈਗੇ ਆ ਜੀ ਹਾਂਜੀ ਹਾਂਜੀ ਹਾਂਜੀ ਉਹ ਆਪਣੇ ਜੀ ਉਹਦੇ ਪੱਖਿਆਂ ਦੇ ਵਿੱਚ ਵੀ ਆਉਂਦੇ ਆ ਜੀ ਆਪਣੇ ਜਿਹੜੇ ਬਲਬ ਲੱਗਦੇ ਨੇ ਜੀ ਕਨੈਕਟ ਹੋ ਜਾਂਦੇ ਉਹਦੇ ਵਿੱਚ ਕੁਲੈਕਟਰੀਸ਼ਨ ਦੀ ਉਹ ਵੀ ਹੈਗੇ ਜੀ ਆਪਣੇ ਕੋਲ ਹਾਂਜੀ ਹਾਂਜੀ ਹਾਂਜੀ ਦੇ ਚਾਰਜ ਜੀ ਹਾਂਜੀ ਹਾਂਜੀ ਮਿਲ ਜਾਣਗੇ ਜੀ ਹਾਂਜੀ ਹਾਂਜੀ ਭਾਅ ਜੀ ਸਾਰੇ ਮਿਲ ਜਾਣਗੇ ਜੀ ਤੁਸੀਂ ਇਹ ਦੱਸੋ ਜੀ ਆਪਣੇ ਕਿੰਨੇ ਕੁ ਹਿਸਾਬ ਨਾਲ ਜੀ ਪੂਰੇ ਬਜਟ ਦੇ ਹਿਸਾਬ ਨਾਲ ਚੱਲਾਂਗੇ ਤਾਂ ਕਿੰਨੇ ਕੁ ਆਪਣੇ ਹੋ ਜਾਣਗੇ ਘਰ ਦੇ ਅਕੋਰਡਿੰਗ ਉੱਥੇ ਦੇਖ ਕੇ ਪਤਾ ਚੱਲੇਗਾ ਜੀ ਕਿੰਨੇ ਕੁ ਕਾ ਬਾਕੀ ਤੋਂ ਜੀ ਤੁਹਾਡਾ ਭਾਅ ਜੀ ਬਜਟ ਕਿੰਨਾ ਕੁ ਹੈ ਜੀ ਉਹ ਹਿਸਾਬ ਨਾਲ ਆਪਾਂ ਦੇਖ ਲਈਏ ਹਾਂਜੀ ਇਹ ਤਾਂ ਜੀ ਹਾਂਜੀ ਹਾਂਜੀ ਵਾਇਰਿੰਗ ਹੋ ਜਾਏਗੀ ਤੁਹਾਡੀ ਆਪਣੇ ਪੂਰੇ ਘਰ ਦੀ ਤਾਰਾਂ ਤੂਰਾ ਪਾ ਕੇ ਪੰਜਾਹ ਕੁ ਹਜ਼ਾਰ ਦਾ ਬਣ ਜੂਗਾ ਜੀ ਆਈਡੀਆ ਬਾਕੀ ਉੱਪਰ ਥੱਲੇ ਹੋ ਸਕਦਾ ਜੀ ਹਾਂਜੀ ਹਾਂਜੀ ਉਹ ਤਾਂ ਜੀ ਬਾਕੀ ਕੰਮ ਕਰਾਂਗੇ ਤਾਂ ਫਿਰ ਉਸ ਹਿਸਾਬ ਨਾਲ ਜੀ ਹਾਂਜੀ ਭਾਅ ਜੀ ਦੇਖੋ ਜੀ ਤੁਸੀਂ ਵਾਇਰਿੰਗ ਵਗੈਰਾ ਤੁਹਾਡੀ ਹੋਵੇਗੀ ਜੀ ਤਿੰਨ ਚਾਰ ਦਿਨ ਲੱਗ ਜਾਣਗੇ ਅਤੇ ਅਸੀਂ ਜੀ ਇੱਕ ਵਾਰੀ ਕੰਮ ਕਰ ਰਹੇ ਜੀ ਇੱਕ ਦਿਨ ਤਾਂ ਸਾਨੂੰ ਲੱਗ ਜਾਏਗਾ ਜੀ ਇੱਕ ਦੋ ਦਿਨ ਇਹਦੇ ਵਿੱਚ ਜੇ ਤਿੰਨ ਦੋ ਕੁ ਦਿਨਾਂ ਤੱਕ ਜੀ ਤੁਹਾਡੇ ਆਪਣੇ ਕਰ ਦਾਂਗੇ ਜੀ ਕੰਮ ਸਟਾਰਟ ਬਾਕੀ ਤੁਹਾਡਾ ਦੇਖਣਾ ਪਵੇਗਾ ਜੀ ਕਿੰਨਾ ਕੁ ਏਰੀਆ ਉਸ ਹਿਸਾਬ ਨਾਲ ਕੰਮ ਹੋਵੇਗਾ ਜੀ ਠੀਕ ਹੈ ਭਾਅ ਜੀ